ਹਾਂ ਇਹ ਗੱਲ ਬਿਲਕੁਲ ਹੀ ਸੱਚ ਹੈ ਮਨੁੱਖ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜਨਾ ਚਾਹੁੰਦਾ ਹੈ ਜੇਕਰ ਮੈਂ ਆਪਣੀਆਂ ਜੜ੍ਹਾਂ ਅਤੇ ਯਾਦਾਂ ਬਾਰੇ ਜਾਣਕਾਰੀ ਸਾਂਝੀ ਕਰਾਂ ਤਾਂ ਮੈਂ ਆਪਣਾ ਪੁਰਾਣਾ ਬਾਲਿਆਂ ਵਾਲਾ ਮਕਾਨ ਹੀ ਲੈ ਲੈਂਦਾ ਹਾਂ ਉਹ ਕੱਚਾ ਮਕਾਨ ਮੇਰੇ ਲਈ ਉਸ ਵਿੱਚ ਮੇਰਾ ਬਚਪਨ ਬੀਤਿਆ ਹੈ ਅਤੇ ਉਸ ਨਾਲ ਹੀ ਮੇਰੀਆਂ ਜੜ੍ਹਾਂ ਲੱਗੀਆਂ ਹਨ ਅੱਜ ਦੇ ਯੁਗ ਵਿੱਚ ਤਾਂ ਜੇਕਰ ਮੈਂ ਪੱਕੇ ਮਕਾਨ ਦੇ ਵਿੱਚ ਰਹਿ ਰਿਹਾ ਹਾਂ ਪ੍ਰੰਤੂ ਮੈਨੂੰ ਅੱਜ ਤੱਕ ਉਹ ਖੁਸ਼ੀ ਨਹੀਂ ਮਿਲੀ ਜੋ ਕਿ ਮੈਨੂੰ ਉਸ ਪੁਰਾਣੇ ਬਾਲਿਆਂ ਵਾਲੇ ਛੱਤ ਦੇ ਹੇਠਾਂ ਰਹਿ ਕੇ ਉਹ ਖੁਸ਼ੀ ਮਿਲੀ ਸੀ ਇਸ ਤਰ੍ਹਾਂ ਉਹ ਮੇਰੇ ਲਈ ਬਹੁਤ ਹੀ ਵਧੀਆ ਮਹਿਸੂਸ ਕਰਨ ਵਾਲੀ ਗੱਲ ਸੀ ਇਸੀ ਤਰ੍ਹਾਂ ਇਹ ਜੜ੍ਹ ਅਤੇ ਯਾਦ ਮੇਰੇ ਲਈ ਬਹੁਤ ਹੀ ਵਧੀਆ ਰਹਿੰਦ